ਮੈਂ ਫਿਲਹਾਲ ਇੱਕ ਕਾਲਜ ਦਾ ਸਟੂਡੈਂਟ ਹਾਂ ਅਤੇ ਮੈਂ ਹੁਣ ਵੀ ਸੈਮੀਨਾਰ ਜਾਂ ਕਲਾਸਾਂ ਆਦਿ ਆਨਲਾਈਨ ਲਗਾਉਂਦਾ ਰਹਿੰਦਾ ਹਾਂ ਇਸ ਤੋਂ ਇਲਾਵਾ ਮੈਂ ਕਰੋਨਾ ਦੇ ਸਮੇਂ ਵੀ ਬਹੁਤ ਕਲਾਸਾਂ ਲਾਈਆਂ ਹਨ ਜੋ ਕਿ ਆਨਲਾਈਨ ਸਨ ਇਸ ਲਈ ਮੈਂ ਕਾਫੀ ਐਪ ਵਰਤੇ ਹਨ ਜਿਹਨਾਂ ਵਿੱਚੋਂ ਕੁਛ ਕੁ ਐਪ ਦੇ ਨਾਮ ਮੈਂ ਲਊਂਗਾ ਜੋ ਕਿ ਹਨ ਜ਼ੂਮ ਅਤੇ ਗੂਗਲ ਮੀਟ ਇਹ ਬਹੁਤ ਹੀ ਵਧੀਆ ਐਪ ਹਨ ਇਹਨਾਂ ਦੀ ਮੈਂ ਬਹੁਤ ਵਰਤੋਂ ਕੀਤੀ ਹੈ ਇਸ ਵਿ ਦੀ ਵਰਤੋਂ ਕਰਨ ਲਈ ਆਪਾਂ ਨੂੰ ਇੱਕ ਲਿੰਕ ਆਉਂਦਾ ਹੈ ਜੋ ਕਿ ਜਿਸ ਨੇ ਐ ਐਡਮਿਨ ਦੁਆਰਾ ਪਾਇਆ ਜਾਂਦਾ ਹੈ ਅਤੇ ਉਸ ਦਾ ਨਾਲ ਇੱਕ ਪਾਸਵਰਡ ਵੀ ਹੁੰਦਾ ਹੈ ਜੋ ਵੀ ਐ ਜੋ ਵੀ ਉਹ ਪਾਸਵਰਡ ਵੀ ਐਡਮਿਨ ਦੁਆਰਾ ਹੀ ਸੈੱਟ ਕੀਤਾ ਜਾਂਦਾ ਹੈ ਇਸ ਨੂੰ ਆਪਾਂ ਇਸ ਲਿੰਕ 'ਤੇ ਕਲਿੱਕ ਕਰਕੇ ਉਸ ਤੋਂ ਬਾਅਦ ਪਾਸਵਰਡ ਭਰਨ ਤੋਂ ਬਾਅਦ ਆਪਾਂ ਮੀਟਿੰਗ ਜੁਆਇਨ ਕਰ ਸਕਦੇ ਹਾਂ ਇਸ ਦੀ ਵਰਤੋਂ ਕਰਕੇ ਆਪਾਂ ਕਿਤੇ ਵੀ ਬੈਠ ਕੇ ਕਿਸੇ ਵੀ ਜਗ੍ਹਾ 'ਤੇ ਕਿਸੇ ਵੀ ਸਮੇਂ ਉਹ ਮੀਟਿੰਗ ਜੁਆਇਨ ਕਰ ਸਕਦੇ ਹਾਂ ਅਤੇ ਅਪ ਆਪਣੇ ਆਪ ਨੂੰ ਉਸ ਮੀਟਿੰਗ ਦਾ ਹਿੱਸਾ ਬਣਾ ਸਕਦੇ ਹਾਂ ਅਤੇ ਇਸ ਮੀਟਿੰਗ ਦੀ ਅ ਵਿੱਚ ਬੈਠ ਕੇ ਆਪਾਂ ਸਭ ਜਾਣਕਾਰੀ ਲੈ ਸਕਦੇ ਹਾਂ ਇਸ ਵਿੱਚ ਅ ਆਪਣੇ ਕੋਲ ਇੱਕ ਵੀਡੀਓ ਅਤੇ ਇੱਕ ਮਾਈਕ ਦੀ ਆਪਸ਼ਨ ਹੁੰਦੀ ਹੈ ਜੋ ਕਿ ਆਪਾਂ ਆਪਣੀ ਵੀਡੀਓ ਅ ਦਿਖਾ ਅ ਵੀਡੀਓ ਦਿਖਾਉਣ ਅਤੇ ਮਾਈਕ ਓਨ ਜਿਸ ਨਾਲ ਆਪਣੀ ਆਵਾਜ਼ ਜਾ ਸਕੇ ਦੀ ਵਰਤੋਂ ਵੀ ਕਰ ਸਕਦੇ ਹਾਂ ਅਤੇ ਉਸ ਤੋਂ ਇਲਾਵਾ ਆਪਾਂ ਇਹਨਾਂ ਨੂੰ ਬੰਦ ਵੀ ਕਰ ਸਕਦੇ ਹਾਂ ਅਤੇ ਇਸ ਤੋਂ ਇਲਾਵਾ ਇੱਥੇ ਇੱਕ ਹੈਂਡ ਰੇਸ ਦੀ ਆਪਸ਼ਨ ਵੀ ਹੁੰਦੀ ਹੈ ਜਿਸ ਦੀ ਵਰਤੋਂ ਕਰਕੇ ਜੇ ਆਪਾਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਉਹ ਪੁੱਛ ਸਕਦੇ ਹਾਂ ਅਤੇ ਇਸ ਤੋਂ ਇਲਾਵਾ ਇੱਥੇ ਇੱਕ ਕਮੈਂਟ ਸੈਕਸ਼ਨ ਵੀ ਹੁੰਦਾ ਹੈ ਜਿੱਥੇ ਆਪਾਂ ਆਪਣੇ ਚੈ ਜਾਂ ਚੈਟ ਆਪਸ਼ਨ ਹੁੰਦਾ ਹੈ ਜਿਸ ਵਿੱਚ ਆਪਾਂ ਟਾਈਪ ਕਰਕੇ ਆਪਣੇ ਪ੍ਰਸ਼ਨ ਐਡਮਿਨ ਤੋਂ ਪੁੱਛ ਸਕਦੇ ਹਾਂ ਅਤੇ ਇਸ ਨਾਲ ਆਪਾਂ ਆਸਾਨੀ ਨਾਲ ਇਸ ਮੀਟਿੰਗ ਦਾ ਹਿੱਸਾ ਬਣ ਸਕਦੇ ਹਾਂ ਅਤੇ ਇਸ ਤੋਂ ਇਲਾਵਾ ਇਸ ਵਿੱਚ ਮੈਨੂੰ ਇਹ ਹੀ ਚੀਜ਼ ਪਸੰਦ ਹੈ ਕਿ ਆਪਾਂ ਕਿਸੇ ਵੀ ਜਗ੍ਹਾ ਬੈਠ ਕੇ ਕਿਸੇ ਵੀ ਸਮੇਂ ਆਪਾਂ ਇਸ ਮੀਟਿੰਗ ਨੂੰ ਜੁਆਇੰਨ ਕਰ ਸਕਦੇ ਹਾਂ ਬਿਨਾਂ ਕਿਸੇ ਅ ਕੋਈ ਫਾਲਤੂ ਸਮਾਂ ਖ਼ਰਾਬ ਕੀਤੇ ਜਾਂ ਕਿਸੇ ਜਾਣ ਕੇ ਜ਼ਰੂਰੂ ਬੈਠਣ ਤੋਂ ਇਲਾਵਾ ਅਤੇ ਇਸ ਤੋਂ ਇਲਾਵਾ ਆਪਾਂ ਨੂੰ ਬਸ ਇੱਕ ਇੰਟਰਨੈਟ ਦੀ ਲੋੜ ਹੁੰਦੀ ਹੈ ਤਾਂ ਇੱਕ ਫੋਨ ਦੀ ਲੋੜ ਹੁੰਦੀ ਹੈ ਜਾਂ ਲੈਪਟਾਪ ਦੀ ਲੋੜ ਹੁੰਦੀ ਜਿਸ ਨਾਲ ਆਪਾਂ ਘਰ ਬੈਠ ਕੇ ਇਸ ਮੀਟਿੰਗ ਨੂੰ ਜੁਆਇਨ ਕਰ ਸਕਦੇ ਹਾਂ ਅਤੇ ਆਪਾਂ ਜਾਣ ਆਉਣ ਦਾ ਖਰਚਾ ਬਚਾ ਸਕਦੇ ਹਾਂ ਅਤੇ ਆਪਣਾ ਸਮਾਂ ਵੀ ਬਚਦਾ ਹੈ